ਪੰਜ ਜਨਵਰੀ ਦੋ ਹਜ਼ਾਰ ਤੇਈ ਅਠਾਰਾਂ ਫਰਵਰੀ ਦੋ ਹਜ਼ਾਰ ਇੱਕੀ ਨੌਂ ਮਈ ਉੱਨੀ ਸੌ ਛਿਆਨਵੇਂ ਪੰਦਰਾਂ ਅਪ੍ਰੈਲ ਦੋ ਹਜ਼ਾਰ ਦਸ ਸੌਲਾਂ ਜੂਨ ਉੱਨੀ ਸੌ ਸਤਾਨਵੇਂ